ਹੈਲੋ ਮੇਰਾ ਨਾਮ ਰੂਮਾਨੀ ਸ਼ਰਮਾ ਹੈ ਮੈਂ ਤੁਹਾਡੇ ਰੈਸਟੋਰੈਂਟ ਤੋਂ ਤਿੰਨ ਓਰ ਪੀਜ਼ੇ ਓਡਰ ਕੀਤੇ ਸੀ ਕਰੀਬ ਬਾਰਾਂ ਵਜੇ ਜੋ ਕਿ ਮੈਨੂੰ ਡੇਢ ਦੋ ਵਜੇ ਤੱਕ ਮਿਲ ਜਾਣੇ ਚਾਹੀਦੇ ਸੀ ਪਰ ਮੈਨੂੰ ਹਾਲੇ ਤੱਕ ਮਿਲੇ ਨਹੀਂ ਹਨ ਮੇਰਾ ਓਡਰ ਕਾਫੀ ਲੇਟ ਹੋ ਚੁੱਕਿਆ ਹੈ ਮੈਨੂੰ ਤੁਹਾਡੀ ਇਸ ਇਹ ਸਰਵਿਸਸ ਬਿਲਕੁਲ ਪਸੰਦ ਨਹੀਂ ਆਈਆਂ ਕਿਰਪਾ ਕਰਕੇ ਮੇਰਾ ਓਡਰ ਜਲਦ ਤੋਂ ਜਲਦ ਪਹੁੰਚਾਉਣ ਦੀ ਕਿਰਪਾ ਕਰੋ ਅਤੇ ਆਪਣੀ ਸਰਵਿਸਸ ਵਿੱਚ ਥੋੜ੍ਹਾ ਸੁਧਾਰ ਲੈ ਕੇ ਆਉ